ਬਿਜਲੀ ਦੀ ਸਮੱਸਿਆ ਹੁਣ ਸਾਡੇ ਇੱਥੇ ਪੰਜਾਬ ਵਿੱਚ ਬਸ ਕਾਫੀ ਹੱਲ ਹੋ ਚੁੱਕੀ ਹੈ ਬਿਜਲੀ ਹੁਣ ਚੌਵੀ ਘੰਟੇ ਹੀ ਰਹਿੰਦੀ ਹੈ ਵੈਸੇ ਦੇਖਿਆ ਜਾਵੇ ਤਾਂ ਆਮ ਤੌਰ 'ਤੇ ਬਿਜਲੀ ਜਿਆਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਨਹੀਂ ਹੁੰਦੀ ਜਦੋਂ ਜ਼ਿਆਦਾ ਘਰਾਂ ਦੇ ਵਿੱਚ ਲੋਕਾਂ ਦੇ ਏ ਸੀ ਚਲਦੇ ਨੇ ਔਰ ਲੋਡ ਜ਼ਿਆਦਾ ਹੋਣ ਦੇ ਕਾਰਨ ਬਿਜਲੀ ਕੋ ਕੱਟ ਲਗਾਉਂਦੇ ਨੇ ਬਸ ਉਸ ਵੇਲੇ ਥੋੜ੍ਹੀ ਦਿੱਕਤ ਹੁੰਦੀ ਆ ਹੁਣ ਵੈਸੇ ਅੱਜ ਕੱਲ੍ਹ ਤਾਂ ਵੈਸੇ ਹਰ ਘਰ 'ਚ ਇਨਵਰਟਰ ਲੱਗਾ ਇਨਵਰਟਰ ਦੇ ਨਾਲ ਇਹ ਹੁੰਦਾ ਕਿ ਪੱਖੇ ਚਲ ਜਾਂਦੇ ਆ ਟਿਊਬਾਂ ਚੱਲ ਜਾਂਦੀਆਂ ਰਾਤ ਨੂੰ ਅਗਰ ਨੀਂਦ ਖ਼ਰਾਬ ਵੀ ਹੋਵੇ ਤਾਂ ਪੱਖੇ ਦੇ ਵਿੱਚ ਬੰਦਾ ਸੌ ਕੇ ਆਪਣੀ ਨੀਂਦ ਪੂਰੀ ਕਰ ਲੈਂਦਾ ਔਰ ਸਰਦੀਆਂ ਦੇ ਵਿੱਚ ਵੀ ਥੋੜ੍ਹਾ ਬਹੁਤਾ ਸਹਾਰਾ ਹੋ ਜਾਂਦਾ ਬੱਤੀ ਹੋਣ ਦੇ ਨਾਲ ਥੋੜ੍ਹਾ ਅੰਧੇਰਾ ਨਹੀਂ ਹੁੰਦਾ ਔਰ ਇਨਵਰਟਰ ਦੇ ਨਾਲ ਲਾਟੂ ਲੂਟੂ ਚਲ ਜਾਂਦੇ ਨੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਨਹੀਂ ਹੁੰਦਾ ਔਰ ਬਿਜਲੀ ਬਿਜਲੀ ਜਿਰੀ ਆ ਪਹਿ ਬਿਜਲੀ ਨਾਲ ਬਿਜਲੀ ਦੇ ਕੱਟ ਲੱਗਣ ਨਾਲ ਬੰਦੇ ਨੂੰ ਪਰੇਸ਼ਾਨੀ ਬਹੁਤ ਜ਼ਿਆਦਾ ਹੁੰਦੀ ਸੀ ਪਹਿਲੇ ਪਰ ਹੁਣ ਨਹੀਂ ਹੁੰਦੀ ਗੌਰਮੈਂਟ ਨੇ ਵੀ ਬੜਾ ਸੁਧਾਰ ਕੀਤਾ ਅਤੇ ਬਿਜਲੀ ਦੇ ਕੱਟ ਹੁਣ ਘੱਟ ਲੱਗਦੇ ਹਨ